ਤੇ ਜਦੋਂ ਮਤਲਬ ਕਿ ਫਿਰ ਮੈਨੂੰ ਮੈਨੂੰ ਦੁਬਾਰਾ ਆਡਰ ਕਰਨਾ ਪਿਆ ਤੇ ਮੈਂ ਦੁਬਾਰਾ ਵੀ ਆਡਰ ਕਰਤਾ ਤੇ ਮੇਰਾ ਪਹਿਲਾਂ ਆਡਰ ਵੀ ਹੋ ਗਿਆ ਤੇ ਨਾਲ ਹੀ ਜਿਹੜੀ ਮੇਰੀ ਪਹਿਲਾਂ ਪੇਮੈਂਟ ਸੀ ਉਹ ਵੀ ਦੁਬਾਰਾ ਮਤਲਬ ਕਿ ਮੇਰੀ ਪੇਮੈਂਟ ਕੱਟੀ ਗਈ ਮੇਰਾ ਦੋ ਵਾਰੀ ਮਤਲਬ ਕਿ ਮਤਲਬ ਉਹ ਪ੍ਰੋਡਕਟ ਨੂੰ ਦੋ ਵਾਰੀ ਮੈਂ ਆਰਡਰ ਕਰ ਦਿੱਤਾ ਤੇ ਮੈਨੂੰ ਦੁੱਖ ਜਾ ਵੀ ਬਹੁਤ ਲੱਗਿਆ ਕਿਉਂਕਿ ਉਹ ਬਹੁਤ ਮਹਿੰਗੀ ਸੀ ਤੇ ਫਿਰ ਮੈਂ ਨਾ ਆਨਲਾਈਨ ਹੀ ਫਲਿਪਕਾਰਟ ਵਾਲਿਆਂ ਦਾ ਨੰਬਰ ਸਰਚ ਕੀਤਾ ਤੇ ਮੈਂ ਉਹਨਾਂ ਨੂੰ ਫੋਨ ਕਰਕੇ ਆਪਣਾ ਦੱਸਿਆ ਕਿ ਮੇਰੇ ਤੋਂ ਗਲਤੀ ਨਾਲ ਦੋ ਵਾਰੀ ਆਰਡਰ ਹੋ ਗਿਆ ਤੇ ਮੇਰਾ ਆਰਡਰ ਨੰਬਰ ਸੀ ਅਠਤਾਲੀ ਪਚਾਨਵੇਂ ਤੇ ਮੈਂ ਨਾਲ ਹੀ ਉਹਨਾਂ ਨੂੰ ਆਪਣਾ ਫੋਨ ਨੰਬਰ ਵੀ ਦੱਸਿਆ ਪਚਾਨਵੇਂ ਅੱਠ ਪਚਾਸੀ ਨੋ ਪੈਂਤੀ ਗਿਆਰਾਂ ਤੇ ਫਿਰ ਉਹਨਾਂ ਨੇ ਮਤਲਬ ਕਿ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਜਲਦੀ ਮੈਨੂੰ ਮਤਲਬ ਕਿ ਦੱਸੋ ਕਿ ਮੈਂ ਇਦਾਂ ਕੀ ਕਰਾਂ ਕਿ ਮੇਰਾ ਕੀ ਆਰਡਰ ਕੈਂਸਲ ਹੋ ਜਾਵੇ ਤੇ ਉਹਨਾਂ ਨੇ ਮੇਰੇ ਤੋਂ ਸਾਰੀ ਜਾਣਕਾਰੀ ਲਈ ਤੇ ਫਿਰ ਮੈਨੂੰ ਕਿਹਾ ਕਿ ਚੋਵੀ ਘੰਟਿਆਂ ਦੇ ਵਿੱਚ ਵਿੱਚ ਤੁਹਾਡਾ ਇਹ ਆਰਡਰ ਕੈਂਸਲ ਹੋ ਜਾਵੇਗਾ ਤੇ ਮੈਨੂੰ ਬਹੁਤ ਖੁਸ਼ੀ ਹੋਈ ਤੇ ਉਹਨਾਂ ਨੇ ਮਤਲਬ ਕੀ ਕਿਉਂਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਮੈਨੂੰ ਆਨਲਾਈਨ ਸ਼ੋਪਿੰਗ ਪਸੰਦ ਹ ਤੇ ਉਹਨਾਂ ਨੇ ਜਦੋਂ ਮੇਰਾ ਇਹ ਇਸੇ ਕਰਕੇ ਮੈਨੂੰ ਆਨਲਾਈਨ ਸ਼ੋਪਿੰਗ ਪਸੰਦ ਹੈ ਕਿਉਂਕਿ ਉਹਨਾਂ ਨੇ ਕਿ ਮੇਰੇ ਜਿਹੜਾ ਮੇਰਾ ਡਬਲ ਆਰਡਰ ਸੀ ਉਹਨੂੰ ਇੱਕ ਨੂੰ ਕੈਂਸਲ ਕਰ ਦਿੱਤਾ